ਤੇਈ ਅਪ੍ਰੈਲ ਮੇਰਾ ਬਰਡੇ ਹੁੰਦਾ ਉੱਨੀ ਅਪ੍ਰੈਲ ਨੂੰ ਮੇਰਾ ਵਿਆਹ ਹੋਇਆ ਸੀ ਸਤਾਈ ਅਪ੍ਰੈਲ ਨੂੰ ਮੇਰੇ ਗੁੜੀਆ ਹੋਈ ਸੀ ਦਸ ਅਗਸਤ ਨੂੰ ਮੇਰੇ ਹ ਹਸਬੈਂਡ ਦਾ ਬਰਡੇ ਆਉਂਦਾ ਅਤੇ ਉੱਨੀ ਫਰਵਰੀ ਨੂੰ ਮੇਰੀ ਭੈਣ ਦਾ ਬਰਡੇ ਆਉਂਦਾ ਅਤੇ ਜਿਹੜੀ ਤਰੀਕ ਹੈ ਉਹ ਦਸੰਬਰ ਦੀ ਦਸੰਬਰ ਨੂੰ ਦਸੰਬਰ ਦੇ ਵਿੱਚ ਅੱਠ ਦਸੰਬਰ ਨੂੰ ਮੇਰੀ ਭੈਣ ਦੀ ਜੁਇਨਿੰਗ ਆਈ ਸੀਗੀ ਗੌਰਮੈਂਟ ਜੋਬ ਦੀ ਅਤੇ ਮੇਰੀ ਜਿਹੜੀ ਹੈਗੀ ਹੈ ਉਹ ਆਈ ਸੀਗੀ ਇਕੱਤੀ ਦਸੰਬਰ ਨੂੰ ਪਰ ਮੈਂ ਜੁਇਨ ਜਿਹੜਾ ਕੀਤਾ ਸੀ ਉਹ ਤੀਹ ਦਸੰਬਰ ਨੂੰ ਕੀਤਾ ਸੀਗਾ ਅਤੇ ਜਿਹੜਾ ਦਿਸੰਬਰ ਦਾ ਮਹੀਨਾ ਉਹ ਸਾਡੇ ਵਾਸਤੇ ਬਹੁਤ ਹੀ ਵਧੀਆ ਰਿਹਾ ਅਤੇ ਬਾਕੀ ਜਿਹੜਾ ਅਪ੍ਰੈਲ ਹੈਗਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਬਹੁਤ ਸਾਰਾ ਕੁਛ ਹੋਇਆ ਤਾਂ ਕਰਕੇ ਅਪ੍ਰੈਲ ਦੀਆਂ ਜਿੰਨੀਆਂ ਵੀ ਤਰੀਕਾਂ ਨੇ ਉਹ ਬਹੁਤ ਯਾਦਗਾਰ ਰਹੀਆਂ ਨੇ ਜਿਵੇਂ ਕਿ ਤੇਈ ਅਪ੍ਰੈਲ ਉੱਨੀ ਅਪ੍ਰੈਲ ਅਤੇ ਸਤਾਈ ਅਪ੍ਰੈਲ ਸਤਾਈ ਅਪ੍ਰੈਲ ਮੈਨੂੰ ਸਭ ਤੋਂ ਮੇਰੇ ਨਜ਼ਦੀਕ ਹੈਗੀ ਕਿਉਂਕਿ ਸਤਾਈ ਅਪ੍ਰੈਲ ਨੂੰ ਜਿਹੜਾ ਹੈਗਾ ਉਹ ਮੇਰੀ ਗੁੜੀਆ ਦਾ ਬਰਡੇ ਹੈਗਾ ਅਤੇ ਸਤਾਈ ਅਪ੍ਰੈਲ ਦੋ ਹਜ਼ਾਰ ਅਠਾਰਾਂ ਨੂੰ ਮੇਰੇ ਗੁੜੀਆ ਹੋਈ ਅਤੇ ਉਹਦੀ ਵੀ ਡੇਟ ਬਹੁਤ ਵਧੀਆ ਅਪ੍ਰੈਲ ਦੇ ਵਿੱਚ ਹੀ ਆ ਗਈ ਅਤੇ ਜਿਵੇਂ ਕਿ ਮੇਰਾ ਬਰਡੇ ਵੀ ਅਤੇ ਮੇਰੀ ਮੈਰਿਜ ਅਨਿਵਰਸਰੀ ਵੀ